ਨਹੀਂ ਮੇਰੇ ਕੋਲ ਫੋਟੋਗ੍ਰਾਫੀ ਦੀ ਰਸਮੀ ਸਿਖਲਾਈ ਨਹੀਂ ਹੈ ਪਰ ਮੈਂ ਆਪਣੀ ਵਧੀਆ ਫੋਟੋਗ੍ਰਾਫੀ ਫੋਟੋਗ੍ਰਾਫਰ ਬਣਨ ਲਈ ਬਹੁਤ ਮਿਹਨਤ ਕਰਦਾ ਹਾਂ ਅਤੇ ਅਤੇ ਤਕਨੀਕਾਂ ਵਰਤਦਾ ਹਾਂ ਅੱਜ ਕੱਲ੍ਹ ਲੋਕ ਵਧੀਆ ਫੋਟੋਗ੍ਰਾਫੀ ਕਰਨ ਲਈ ਅਲੱਗ ਅਲੱਗ ਵਧੀਆ ਵਧੀਆ ਫੋਨ ਕੈਮਰੇ ਆਦਿ ਖਰੀਦਦੇ ਹਨ ਜਿਸ ਨਾਲ ਫੋਟੋ ਵਧੀਆ ਆਉਂਦੀ ਹੈ ਅਤੇ ਅਸੀਂ ਅਲੱਗ ਅਲੱਗ ਐਪਾਂ ਤੋਂ ਫੋਟੋ ਐਡਿਟ ਕਰ ਸਕਦੇ ਹਾਂ ਜਿਸ ਨਾਲ ਫੋਟੋ ਹੋ ਰਹੀ ਵਧੀਆ ਬਣ ਜਾਂਦੀ ਹੈ ਅਤੇ ਫੋਟੋ ਸਾਫ ਹੋ ਜਾਂਦੀ ਹੈ ਅਤੇ